ਯੋਗਾ ਦਾ ਅਭਿਆਸ ਜਿਵੇਂ ਮੈਂ ਰੋਜ਼ ਕਰਦੀ ਹਾਂ ਅਤੇ ਸਵੇਰੇ ਉੱਠਦੇ ਹੀ ਸਭ ਤੋਂ ਪਹਿਲਾਂ ਮੈਂ ਉਹਦਾ ਅਭਿਆਸ ਕਰਦੀ ਹਾਂ ਕਿਉਂਕਿ ਉਹਦੇ ਨਾਲ ਮੈਨੂੰ ਬਹੁਤ ਮਨ ਨੂੰ ਸ਼ਾਂਤੀ ਮਿਲਦੀ ਹੈ ਅਤੇ ਮੇਰਾ ਪੂਰਾ ਦਿਨ ਬਹੁਤ ਵਧੀਆ ਨਿਕਲਦਾ ਹੈ ਜਿਵੇਂ ਕਿ ਅੱਜ ਤੋਂ ਇੱਕ ਦੋ ਸਾਲ ਪਹਿਲਾਂ ਮੈਂ ਬਹੁਤ ਜ਼ਿਆਦਾ ਪ੍ਰੇਸ਼ਾਨ ਰਹਿੰਦੀ ਸੀ ਅਤੇ ਮੇਰੀ ਮਾਨਸਿਕ ਹਾਲਤ ਓਨੀ ਨਹੀਂ ਸੀ ਕਿ ਮੈਂ ਹਰ ਚੀਜ਼ ਨੂੰ ਚੰਗੀ ਤਰ੍ਹਾਂ ਲੈ ਸਕਾਂ ਆਪਣੀ ਜ਼ਿੰਦਗੀ 'ਚ ਮੈਂ ਬਹੁਤ ਖਿਝੀ ਖਿਝੀ ਰਹਿੰਦੀ ਸੀ ਅਤੇ ਬਹੁਤ ਹੀ ਜ਼ਿਆਦਾ ਇਰੀਟੇਟਿਡ ਰਹਿੰਦੀ ਸੀ ਪਰ ਜਦੋਂ ਤੋਂ ਮੈਨੂੰ ਕਿਸੇ ਨੇ ਸਲਾਹ ਦਿੱਤੀ ਕਿ ਮੈਨੂੰ ਯੋਗਾ ਸਟਾਰਟ ਕਰਨਾ ਚਾਹੀਦਾ ਮੈਂ ਸਵੇਰੇ ਉੱਠ ਕੇ ਮੈਡੀਟੇਸ਼ਨ ਕਰਦੀ ਹਾਂ ਦੋ ਤਿੰਨ ਆਸਨ ਕਰਦੀ ਹਾਂ ਜਿਵੇਂ ਤਾੜ ਆਸਨ ਦੂਜੇ ਹੋਰ ਦੋ ਤਿੰਨ ਆਸਨ ਅਤੇ ਉਹਦੇ ਨਾਲ ਮੈਨੂੰ ਬਹੁਤ ਜ਼ਿਆਦਾ ਸ਼ਾਂਤੀ ਮਿਲਦੀ ਹੈ ਅਤੇ ਮੇਰਾ ਪੂਰਾ ਦਿਨ ਬਹੁਤ ਚੰਗਾ ਜਾਂਦਾ ਹੈ ਜਦੋਂ ਮੈਂ ਖਿਝੀ ਖਿਝੀ ਰਹਿੰਦੀ ਸੀ ਜਦੋਂ ਮੈਂ ਧੀਰੇ ਧੀਰੇ ਇਹਨੂੰ ਕਰਨਾ ਸਟਾਰਟ ਕੀਤਾ ਅਤੇ ਉਸ ਤੋਂ ਬਾਅਦ ਮੇਰੇ ਮਾਨਸਿਕ ਅਤੇ ਭਾਵਨਾ ਭਾਵਨਾਤਮਿਕ ਤੰਦਰੁਸਤੀ ਵਿੱਚ ਵੀ ਬਹੁਤ ਸਾਰੇ ਚੇਂਜਿਜ਼ ਆਏ ਜਿਹਦੇ ਕਾਰਨ ਮੈਂ ਹੁਣ ਇੱਕ ਬਹੁਤ ਹੀ ਸੁਖੀ ਲਾਈਫ ਜੀਣੀ ਪਈ ਹਾਂ ਜਿਹਦੇ ਵਿੱਚ ਮੈਨੂੰ ਕੋਈ ਵੀ ਇੱਦਾਂ ਦੀ ਟੈਸ਼ਨ ਨਹੀਂ ਹੈਗੀ ਮੈਂ ਹਰ ਚੀਜ਼ ਨੂੰ ਬਹੁਤ ਸ਼ਾਂਤੀ ਨਾਲ ਪੂਰਾ ਕਰਦੀ ਹਾਂ ਅਤੇ ਉਸ ਤੋਂ ਬਾਅਦ ਹੀ ਅਗਲੇ ਦਿਨ ਮਤਲਬ ਜਿਵੇਂ ਮੇਰੀ ਰੁਟੀਨ ਹੀ ਬਣ ਗਿਆ ਕਿ ਮੈਂ ਰੋਜ਼ ਸਵੇਰੇ ਉੱਠ ਕੇ ਯੋਗਾ ਕਰਨਾ ਹੀ ਕਰਨਾ ਹੈ ਨਹੀਂ ਤਾਂ ਮੈਨੂੰ ਦਿਨ ਵਿੱਚ ਕੁਝ ਨਾ ਕੁਝ ਇੱਦਾਂ ਦਾ ਲੱਗਦਾ ਕਿ ਜਿਵੇਂ ਮੈਂ ਮੇਰਾ ਦਿਨ ਵੀ ਪੂਰਾ ਨਹੀਂ ਹੋਇਆ ਤਾਂ ਇਸ ਕਰਕੇ ਮੇਰੀ ਮਾਨਸਿਕ ਅਤੇ ਭਾਵਨਾਤਮਿਕ ਤੰਦਰੁਸਤੀ 'ਤੇ ਬਹੁਤ ਚੰਗਾ ਅਸਰ ਪਿਆ ਹੈ ਅਤੇ ਮੈਂ ਸਾਰਿਆਂ ਨੂੰ ਇਹ ਜ਼ਰੂਰ ਸਲਾਹ ਦੇਵਾਂਗੀ ਕਿ ਉਹ ਯੋਗਾ ਕਰਨ ਕਿਉਂਕਿ ਇਹਦੇ ਨਾਲ ਮੈਨੂੰ ਇੱਕ ਇੱਦਾਂ ਦੀ ਸ਼ਾਂਤੀ ਮਿਲੀ ਹੈ ਜਿਹਦੇ ਨਾਲ ਮੈਂ ਆਪਣੀ ਜ਼ਿੰਦਗੀ ਅੱਗੇ ਵਧਾਉਣ ਲਈ ਬਹੁਤ ਜ਼ਿਆਦਾ ਪ੍ਰੇਰਿਤ ਹੋਈ ਹਾਂ ਅਤੇ ਮੈਨੂੰ ਬਹੁਤ ਜ਼ਿਆਦਾ ਮੋਟੀਵੇਸ਼ਨ ਮਿਲੀ ਹੈ ਕਿ ਹਾਂ ਯੋਗਾ ਕਰਨ ਦੇ ਨਾਲ ਮੇਰੀ ਜਿਹੜੀ ਪ੍ਰੋਬਲਮਸ ਨੇ ਉਹ ਸੋਲਵ ਹੋ ਸਕਦੀਆਂ ਨੇ ਮੈਡੀਟੇਸ਼ਨ ਨੇ ਮੈਨੂੰ ਬਹੁਤ ਹੱਦ ਤੱਕ ਠੀਕ ਕੀਤਾ ਹੈ